ਜਦੋਂ ਮੇਰੇ ਮਿੱਤਰ ਨੇ ਆਪਣੀ ਜ਼ਿੰਦਗੀ ਬਾਰੇ ਇੱਕ ਹੋਈ ਘਟਨਾ ਬਾਰੇ ਮੈਨੂੰ ਦੱਸਿਆ ਔਰ ਉਸ ਘਟਨਾ ਬਾਰੇ ਸ ਸਾਰਾ ਮੈਂ ਉਹਨੂੰ ਪਰੋਪਰ ਚੰਗੀ ਤਰ੍ਹਾਂ ਲਿਖ ਕੇ ਉਸ ਘਟਨਾ ਦਾ ਵਿਸਥਾਰ ਪੂਰਵਕ ਦੱਸਿਆ ਔਰ ਲਿਖ ਕੇ ਦਿੱਤਾ ਔਰ ਜਦੋਂ ਉਨ੍ਹਾਂ ਨੇ ਇਹ ਚੀਜ਼ ਪੜ੍ਹੀ ਤਾਂ ਉਹਨਾਂ ਨੂੰ ਉਹ ਚੀਜ਼ ਬਹੁਤ ਪਸੰਦ ਆਈ ਜੋ ਕਿ ਮੇਰਾ ਅੱਜ ਵੀ ਮਾਣ ਕਰਦੇ ਹਨ ਕਿ ਤੁਸੀਂ ਉਸ ਚੀਜ਼ ਨੂੰ ਜੋ ਮੈਂ ਆਪਣੇ ਜੀਵਨ 'ਚ ਮਹਿਸੂਸ ਨਹੀਂ ਕਰ ਸਕਿਆ ਤੁਸੀਂ ਮੈਨੂੰ ਉਸ ਬਾਰੇ ਮਹਿਸੂਸ ਕਰਾ ਕੇ ਮੈਨੂੰ ਬਹੁਤ ਚੰਗਾ ਮਸੂ ਲੱਗਿਆ ਜੀ